ਸਤਿ ਸ਼੍ਰੀ ਅਕਾਲ ਵੀਰੇ ਮੈਨੂੰ ਨਾ ਤੁਹਾਡਾ ਨੰਬਰ ਮਿਲਿਆ ਸੀ ਇੱਕ ਆਨਲਾਇਨ ਸਾਈਟ 'ਤੇ ਕੀ ਤੁਸੀਂ ਫਰੀਦਕੋਟ ਦੇ ਲੋਕਲ ਰਹਿਣ ਵਾਲੇ ਹੋ ਅਤੇ ਮੈਂ ਇੱਥੇ ਹੋਰ ਕਿਸੇ ਡਿਸਟ੍ਰਿਕਟ ਤੋਂ ਆਈ ਸੀ ਕਿ ਮੈਨੂੰ ਇੱਥੇ ਪਤਾ ਲੱਗਿਆ ਸੀ ਕਿ ਇੱਥੇ ਬਹੁਤ ਗੁਰਦੁਆਰੇ ਨੇ ਜਿਹੜੇ ਕਿ ਵਧੀਆ ਬਣੇ ਹੋਏ ਨੇ ਅਤੇ ਮੈਂ ਉਹਨਾਂ ਨੂੰ ਦੇਖਣਾ ਚਾਹੁੰਦੀ ਸੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਉਹਨਾਂ ਦੀ ਲੋਕੇਸ਼ਨ ਕੀ ਆ ਅਤੇ ਮੈਂ ਕਿਵੇਂ ਜਾ ਸਕਦੀ ਹਾਂ ਠੀਕ ਹੈ ਠੀਕ ਹੈ ਅਤੇ ਆਪਣੇ ਇੱਥੇ ਠੀਕ ਹੈ ਅਤੇ ਆਪਣੇ ਇੱਥੇ ਫਰੀਦਕੋਟ ਸ਼ਹਿਰ ਦੇ ਵਿੱਚ ਕੋਈ ਹੋਵੇਗਾ ਜਿਹੜਾ ਕਿ ਮੈਨੂੰ ਦੱਸ ਸਕੇ ਕੀ ਮੈਂ ਇੱਥੇ ਕਿਵੇਂ ਜਾ ਸਕਦੀ ਅਤੇ ਮੈਨੂੰ ਉੱਥੇ ਗੁਰਦੁਆਰੇ ਘੁੰਮਾ ਸਕੇ ਕੋਈ ਟੂਰਿਸਟ ਗਾਈਡ ਕਹਿ ਦਿੰਦੇ ਹਾਂ ਜਿੱਦਾਂ ਆਪਾਂ ਹਾਂਜੀ ਬੋਲੋ ਹਾਂਜੀ ਹਾਂਜੀ ਓਕੇ ਕੀ ਨੇਮ ਆ ਇਹਨਾਂ ਦਾ ਠੀਕ ਹੈ ਅਤੇ ਇਹ ਮੈਨੂੰ ਮਤਲਬ ਦੱਸ ਦੇਣਗੇ ਪੂਰਾ ਕੀ ਮਤਲਬ ਗੁਰਦੁਆਰੇ ਬਾਰੇ ਗੁਰਦੁਆਰੇ ਦੇ ਪੁਰਾਣੇ ਕਲਚਰ ਬਾਰੇ ਸਾਰਾ ਕੁਝ ਇੱਕ ਮੈਂ ਸੁਣਿਆ ਸੀ ਇੱਥੇ ਫਰੀਦਕੋਟ ਤੋਂ ਕੋਈ ਗੋਦੜੀ ਸਾਹਿਬ ਗੁਰਦੁਆਰਾ ਠੀਕ ਹੈ ਮਨਜੀਤ ਸਿੰਘ ਹੁਣ ਫੋਨ ਨੰਬਰ ਦਿੱਤਾ ਉਹਨਾਂ ਨਾਲ ਠੀਕ ਹੈ ਅਤੇ ਹੋਰ ਜੇ ਕੋਈ ਤੁਹਾਨੂੰ ਹੋਵੇ ਜਾਂ ਪਤਾ ਲੱਗੇ ਠੀਕ ਹੈ ਅਤੇ ਤੁਸੀਂ ਮੈਨੂੰ ਪਲੀਜ਼ ਦੱਸ ਦੇਣਾ ਕਿ ਜੋ ਮੈਂ ਦੱਸ ਸਕਾਂ ਜਾਂ ਜਾਣ ਸਕਾਂ ਗੁਰਦੁਆਰਿਆਂ ਬਾਰੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ

ਠੀਕ ਹੈ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਜੀ